ਸਾਡੇ ਪਰਿਵਾਰਾਂ ਦੇ ਵਿੱਚ ਅੱਜ ਵੀ ਸੱਭਿਆਚਾਰ ਸੱਭਿਆਚਾਰਕ ਪਰਿਵਾਰ ਨਾਲ ਜੁੜੇ ਹੋਣ ਕਰਕੇ ਅੱਜ ਵੀ ਘਰਾਂ ਦੇ ਵਿੱਚ ਮੱਥਾ ਟੇਕਣ ਦਾ ਜਠੇਰੇ ਪੂਜਣ ਦਾ ਰਿਵਾਜ਼ ਹੈ ਲੰਮਾ ਇਤਿਹਾਸ ਚੱਲਿਆ ਆ ਰਿਹਾ ਹੈ ਇਹ ਪਤਾ ਨਹੀਂ ਸ਼ੁਰੂ ਕਿਹਨੇ ਕੀਤਾ ਸੀਗਾ ਚੱਲਦਾ ਆ ਰਿਹਾ ਸੀ ਉੱਦਾਂ ਹੀ ਭੇਡਚਾਲਾਂ ਵੀ ਚੱਲੇ ਜਾ ਰਹੇ ਚੱਲੇ ਜਾ ਰਹੇ ਚੱਲੇ ਜਾ ਰਹੇ ਜਿੱਦਾਂ ਹੁਣ ਨਵੇਂ ਵਿਆਹਿਆ ਲੈ ਕੇ ਆਉਂਦਾ ਵਿਆਹ ਕੇ ਉਹਦੇ ਬਾਅਦ 'ਚੋਂ ਉਹਦੇ ਜਿਹੜੇ ਪਹਿਰਾਵੇ ਜਾਂ ਕੁਛ ਵੀ ਜਿਹੜੇ ਤਿਉਹਾਰ ਹੈ ਜਾਂ ਉਹਦੇ ਹਿਸਾਬ ਨਾਲ ਚੱਲੇ ਆ ਰਹੇ ਆ ਪੁਰਾਣੇ ਹਿਸਾਬ ਨਾਲ ਜਿੱਦਾਂ ਸਾਡੇ ਵਿਆਹ ਹੁੰਦੇ ਹਨ ਪਹਿਲਾਂ ਉਹ ਗੋ ਮਿਲਾਏ ਜਾਂਦੇ ਹਨ ਟੇਵੇ ਮਿਲਾਏ ਜਾਂਦੇ ਹਨ ਉਹ ਅੱਜ ਵੀ ਟੇਵੇ ਮਿਲਾਏ ਜਾਣ ਦਾ ਰਿਵਾਜ਼ ਜਿਹੜਾ ਚੱਲਦਾ ਆ ਰਿਹਾ ਹੈ ਵਿਆਹ ਤੋਂ ਬਾਅਦ ਜਠੇਰੇ ਪੂਜਣੇ ਆਟਾ ਪਾ ਕੇ ਉਹ ਵੀ ਇਹ ਰਿਵਾਜ਼ ਬੜੇ ਪੁਰਾਣੇ ਹੈ ਸਾਡੇ ਤਿਉਹਾਰ ਜਿਹੜੇ ਹੈ ਦਿਵਾਲੀ ਹੋਲੀ ਵਿਸਾਖੀ ਜਿਹੜੇ ਤਿਉਹਾਰ ਪੰਜਾਬੀਆਂ ਦੇ ਹਨ ਉਹ ਚੱਲਦੇ ਆ ਰਹੇ ਆ ਚੱਲੀ ਜਾਣੇ ਲੋਹੜੀ ਜਿਹੜੀ ਆ ਸਾਡੇ ਪੰਜਾਬ 'ਚ ਚੱਲੀ ਇਹਨੂੰ ਬਾਕੀ ਬਾਕੀ ਆਲੇ ਦੁਆਲੇ ਜਿਹੜੇ ਪੰਜਾਬ ਦੇ ਹਿੱਸੇ ਹੋਏ ਉਹਨਾਂ ਨੇ ਅਪਣਾ ਲਿਆ ਹੁਣ ਸਾਡੇ ਜਿਹੜੇ ਉਹ ਰੈ ਜਦ ਹਿੱਸੇ ਪੰਜਾਬ ਦਾ ਅਲੱਗ ਉਹਨਾਂ ਵਿੱਚ ਵੀ ਮਨਾਇਆ ਜਾ ਰਿਹਾ ਲੋਹੜੀ ਵਿਸਾਖੀ ਮਨਾਈ ਜਾ ਰਹੀ ਹੈ ਵਿਸਾਖੀ ਵੀ ਪੰਜਾਬ ਤੋਂ ਹੁਣ ਬਾਹਰ ਦੇ ਵਿਦੇਸ਼ਾਂ 'ਚ ਲੋਕ ਚਲੇ ਗਏ ਉੱਥੇ ਵੀ ਵਿਸਾਖੀ ਮਨਾਈ ਜਾਂਦੀ ਤਿਉਹਾਰ ਮਨਾਇਆ ਜਾ ਰਿਹਾ ਲੋਹੜੀ ਸਾਡੇ ਪੰਜਾਬ ਤੋਂ ਚੱਲੀ ਬਾਹਰ ਚੱਲ ਗਈ ਸਾਡੇ ਜਿਹੜੇ ਪਰਿਵਾਰ ਦਾ ਹਿੱਸਾ ਹੈ ਲੋਹੜੀ ਜਿਹੜੀ ਆ ਵਿਸਾਖੀ ਜਿਹੜੀ ਸਾਡੇ ਪਰਿਵਾਰਾਂ ਦਾ ਹਿੱਸਾ ਆ ਸਾਡੇ ਜਿਹੜੇ ਵਿਆਹਾਂ ਦੇ ਘਰ ਮ ਮੰਦਰ ਗੁਰਦੁਆਰਿਆਂ ਜਾਂ ਘਰ ਮੰਦਰ ਬਣਾ ਕੇ ਮੱਥਾ ਟੇਕਣਾ ਉਹਨੂੰ ਫਿਰ ਪੂਰੀ ਸੁਚੱਜਿਆ ਰੱਖਣੀ ਇਹ ਸਾਡੇ ਜਿਹੜੇ ਪਰਿਵਾਰਾਂ ਦਾ ਹਿੱਸਾ ਇਹ ਕੋਈ ਉਣਾ ਕੋਈ ਦੱਸ ਕੇ ਨਹੀਂ ਗਿਆ ਕੋਈ ਬਣਾ ਕੇ ਇਹ ਜਿਹੜੇ ਚੱਲੇ ਆ ਰਹੇ ਇਹਨੂੰ ਅੱਗੇ ਪੀੜੀ ਦੇ ਵਿੱਚ ਚੱਲੀ ਜਾਣਾ ਇਹਨੇ ਚੱਲੀ ਜਾਣੇ ਕਦੀ ਖਤਮ ਨਹੀਂ ਹੋਣਾ ਇਹ ਸਾਡੇ ਪਰਿਵਾਰ ਦਾ ਇਹ ਜਿਹੜੇ ਸੱਭਿਆਚਾਰ ਆ ਸਾਡਾ ਹਿੱਸਾ ਹੀ ਆ ਇਹ ਚੱਲੀ ਜਾਣਾ ਇੱਦਾਂ ਹੀ